ਹੈਲੋ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਰਾਜੂ ਕਰਿਆਨਾ ਤੋਂ ਬੋਲਦੇ ਹੋ ਜੀ ਵੀਰ ਜੀ ਅਸੀਂ ਨਾ ਪਰਚੂਨ ਦਾ ਸਮਾਨ ਲੈਣਾ ਸੀ ਜੀ ਸੌਦਾ ਲੈਣਾ ਸੀਗਾ ਵੀਰ ਜੀ ਅਸੀਂ ਚੌਲ ਚੂਲ ਲੈਣੇ ਸੀ ਬਾਸਪਤੀ ਚੌਲ ਖੀਰ ਵਾਲੇ ਚੌਲ ਇੰਡੀਆ ਗੇਟ ਚੌਲ ਠੀਕ ਹੈ ਜੀ ਦਾਲਾਂ ਦੁਲਾਂ ਲੈਣੀਆਂ ਸੀ ਅਤੇ ਵੀਰ ਜੀ ਸਾਡੇ ਨਾ ਗਵਾਂਢ 'ਚ ਵਿਆਹ ਹੋਇਆ ਸੀਗਾ ਜੀ ਅਤੇ ਉੱਥੋਂ ਆਏ ਤੁਹਾਡਾ ਸਮਾਨ ਆਇਆ ਸੀ ਸਾਨੂੰ ਬਹੁਤ ਵਧੀਆ ਲੱਗਿਆ ਜੀ ਸਾਨੂੰ ਤੁਹਾਡਾ ਨੰਬਰ ਉਹਨਾਂ ਤੋਂ ਹੀ ਮਿਲਿਆ ਹੈ ਜੀ ਹਾਂਜੀ ਹਾਂਜੀ ਦਾਲਾਂ ਚਾਹੀਦੀਆਂ ਜੀ ਮੂੰਗੀ ਦਾਲ ਹਰੀ ਦਾਲ ਵੀ ਪੀਲੀ ਦਾਲ ਚਾਹੀਦੀ ਹੈ ਜੀ

ਹਾਂਜੀ ਚਨੇ ਚੌਲ ਚੌਲਾਂ ਦਾ ਕੀ ਰੇਟ ਹੈ ਜੀ ਬਾਸਮਤੀ ਚੌਲਾਂ ਦੀ ਹਾਂਜੀ ਠੀਕ

ਠੀਕ ਹੈ ਜੀ ਠੀਕ ਹੈ ਜੀ ਕਹਿਣ ਦਾ ਭਾਵ ਇਹ ਹੈ ਜੀ ਅਸੀਂ ਸਾਰਾ ਸਮਾਨ ਲੈਣਾ ਜੀ ਉਹਦਾ ਕਰਿਆਨੇ ਦਾ ਜੀ ਦਾਲਾਂ ਵਗੈਰਾ ਜੀ ਸਾਡੇ ਇੱਥੇ ਦੋ ਤਿੰਨ ਮੈਰਿਜ ਆ ਜੀ ਹਾਂਜੀ ਅਸੀਂ ਸਮਾਨ ਲੈਣਾ ਜੀ ਤੁਸੀਂ ਸਾਨੂੰ ਆਪਦਾ ਐਡਰੈਸ ਦੱਸ ਦੁੰਗੇ ਜੀ ਅਤੇ ਅਸੀਂ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਸਾਨੂੰ ਵਧੀਆ ਤੋਂ ਵਧੀਆ ਚੀਜ਼ ਦਿਓ ਜੀ ਪਲੀਜ਼ ਰਿਕੁਐਸਟ ਹੈ ਜੀ ਠੀਕ ਹੈ ਜੀ ਅਤੇ ਹਾਂਜੀ ਠੀ ਠੀਕ ਹੈ ਜੀ ਸਾਨੂੰ ਚੌਲਾਂ ਬਾਰੇ ਜਾਣਕਾਰੀ ਦੇ ਸਕਦੇ ਹੋ ਜੀ ਸਾਰੇ ਚੌਲਾਂ ਬਾਰੇ ਜਾਣਕਾਰੀ ਦਿਓ ਜੀ ਪਲੀਜ ਖੀਰ ਵਾਲੇ ਚੌਲ ਬਾਰੇ ਜੀ ਇੰਡੀਆ ਗੇਟ ਚੌਲ ਜੀ ਠੀਕ ਹੈ ਜੀ ਸਾਨੂੰ ਸਾਰੇ ਉਹਦੇ ਬਾਰੇ ਜਾਣਕਾਰੀ ਦੇ ਸਕਦੇ ਕੀ ਕੀ ਰੇਟ ਆ ਕੀ ਵਧੀਆ ਜੀ ਪੂਰੇ ਵਧੀਆ ਲੈਣੇ ਹੈ ਜੀ ਸੁਸਰੀ ਵਾਲੇ ਨਹੀਂ ਲੈਣੇ ਜੀ ਪਲੀਜ ਰਿਕੁਐਸਟ ਹੀ ਆ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਸਾਨੂੰ ਮੈਰਿਜ ਵਾਸਤੇ ਚਾਹੀਦੇ ਜੀ ਸਾਡੇ ਮੈਰਿਜ ਆ ਜੀ ਅਸੀਂ ਉੱਥੇ ਬਣਾਉਣੇ ਆ ਜੀ ਕੁਛ ਅਗੇਜਮੈਂਟ 'ਤੇ ਬਣਾਉਣੇ ਜੀ ਕੁਛ ਬਰਾਤ ਵਾਲੇ ਦਿਨ ਬਣਾਉਣੇ ਆ ਜੀ ਠੀਕ ਹੈ ਜੀ ਅਤੇ ਇਹਨਾਂ ਦਾ ਹੋਰ ਕੋਈ ਠੀਕ ਹੈ ਜੀ ਦਾਲਾਂ ਵਗੈਰਾ ਦਾ ਰੇਟ ਦੱਸ ਦੋਂਗੇ ਜੀ ਪਲੀਜ ਠੀਕ ਹੈ ਜੀ ਹਰੀ ਦਾਲ ਠੀਕ ਠੀਕ ਹੈ ਜੀ ਠੀਕ ਹੈ ਜੀ ਲੂਣ ਮਿਰਚ ਮਸਾਲਾ ਜੀ ਅਸੀਂ ਸਾਰਾ ਕੁਝ ਲੈਣਾ ਜੀ ਜੇ ਸਾਨੂੰ ਤੁਸੀਂ ਉਹਦਾ ਰੇਟ ਦੱਸ ਦਿਓ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਵੀਰ ਜੀ ਠੀਕ ਧੰਨਵਾਦ